ਸਮੁੱਚੀ ਸਿਹਤ ਅਤੇ ਤੰਦਰੁਸਤੀ ਲਈ ਤੈਰਾਕੀਆਂ ਦੇ ਬਹੁਤ ਸਾਰੇ ਫਾਇਦੇ ਹਨ ਸਾਹ ਨਿਯੰਤਰਨ ਵਿੱਚ ਵੀ ਬਹੁਤ ਜ਼ਿਆਦਾ ਮਦਦ ਕਰਦਾ ਹੈ ਕੋਈ ਜਿਵੇਂ ਜਿਵੇਂ ਕੋਈ ਬੱਚਾ ਕੋਈ ਬੱਚਾ ਜਾਂ ਬਜ਼ੁਰਗ ਪਾਣੀ ਵਿੱਚ ਡੁੱਬ ਜਾਂਦਾ ਹੈ ਤਾਂ ਤੈਰਾਕੀ ਝੱਟ ਹੀ ਉਸਨੂੰ ਝੱਟ ਹੀ ਉਸਨੂੰ ਬਚਾ ਸਕਦੇ ਹਨ ਪਰ ਜੇ ਤੈਰਾਕੀ ਨਾ ਹੋਣ ਤਾਂ ਬੱਚਿਆਂ ਬੱਚੇ ਜਾਂ ਬਜ਼ੁਰਗਾਂ ਦੀ ਹੋਰ ਵੀ ਬੱਚਿਆਂ ਦੀ ਜਾਨ ਵੀ ਜਾ ਸਕਦੀ ਹੈ ਸਾਨੂੰ ਵੀ ਤਰਾ ਤਰਾਕੀਆਂ ਵਾਂਗੂ ਤੈਰਨਾ ਸਿ ਸਿੱਖਣਾ ਚਾਹੀਦਾ ਹੈ ਇਹ ਸਾਹ ਨਿਯੰਤਰਨ ਵਿੱਚ ਵੀ ਬਹੁਤ ਜ਼ਿਆਦਾ ਮਦਦ ਕਰਦਾ ਹੈ ਇਸ ਨਾਲ ਬੰਦਾ ਫਿੱਟ ਵੀ ਰਹਿੰਦਾ ਹੈ ਅਤੇ ਉਹਨੂੰ ਪਾਣੀ ਵਿੱਚ ਆਉਣ ਵਾਲੀਆਂ ਮੁਸ਼ਕਲਾਂ ਨਾਲ ਵੀ ਸਾਹਮਣਾ ਕਰਨਾ ਪੈਂਦਾ ਹੈ ਜੇਕਰ ਕੋਈ ਤੈਰਾਕੀ ਤੈਰਾਕੀ ਤੈਰਾਕੀ ਨਹੀਂ ਕਰਦਾ ਤਾਂ ਉਹ ਪਾਣੀ ਵਿੱਚ ਸਕਸ਼ਮ ਹੈ ਅਤੇ ਉਹ ਪਾਣੀ ਵਿੱਚ ਡੁੱਬਣ ਦਾ ਕਾਰਨ ਵੀ ਹੋ ਸਕਦਾ ਹੈ ਕਈਆਂ ਕਈਆਂ ਨੂੰ ਤਰਾ ਕਈਆਂ ਨੂੰ ਪਾਣੀ ਵਿੱਚ ਤੈਰਨਾ ਨਹੀਂ ਆਉਂਦਾ ਉਹ ਪਾਣੀ ਵੀ ਉਹ ਪਾਣੀ ਵਿੱਚ ਹੀ ਡੁੱਬ ਕੇ ਮਰ ਜਾਂਦੇ ਹਨ ਅਤੇ ਉਹਨਾਂ ਵਿੱਚ ਲੰਗਸ ਵਿੱਚ ਪਾਣੀ ਭਰ ਜਾਂਦਾ ਹੈ ਅਤੇ ਉਹ ਜ ਜਲਦੀ ਨਹੀਂ ਜਲਦੀ ਨਹੀਂ ਕਈ ਤਾਂ ਬ ਬੱਚੇ ਆਪਣੀ ਜਾਨ ਤੋਂ ਹੱਥ ਗਵਾਹ ਬੈਠਦੇ ਹਨ ਪਰ ਕਈ ਬਚ ਬੱਚ ਜਾਂਦੇ ਹਨ ਅਤੇ ਉਹਨਾਂ ਨੂੰ ਰਿਕਵਰੀ ਲਈ ਬਹੁਤ ਜ਼ਿਆਦਾ ਟਾਈਮ ਦੇਣਾ ਚਾਹੁੰਦਾ ਹੈ ਇਸ ਕਰਕੇ ਬੇਨਤੀ ਹੈ ਕਿ ਕਿਸੇ ਹੋਰ ਵਿੱਚ ਜਾਣਾ ਵਾਂ ਤੈਰਾਕੀਆਂ ਨੂੰ ਨਾਲ ਲੈ ਕੇ ਜਾਣਾ ਚਾਹੀਦਾ ਹੈ ਅਤੇ ਹੋਰ ਤੈਰਾਕੀਆਂ ਲਈ ਤੈਰਾਕੀਆਂ ਦੀ ਤੰਦਰੁਸਤੀ ਲਈ ਬਹੁਤ ਜ਼ਿਆਦਾ ਫਾਇਦੇ ਹਨ ਅਤੇ ਸਾਹ ਨਿਯੰਤਰਨ ਵਿੱਚ ਵੀ ਬਹੁਤ ਜ਼ਿਆਦਾ ਮਦਦ ਕਰਦਾ ਹੈ